ਮੈਂ ਆਪਣੇ ਵਿਆਹ ਤੋਂ ਬਾਅਦ ਆਪਣਾ ਪਸ਼ੂ ਪਾਲਣ ਦਾ ਕਾਰੋਬਾਰ ਸ਼ੁਰੂ ਕੀਤਾ ਮੈਂ ਸ਼ ਪਸ਼ੂ ਪਾਲਣ ਲਈ ਹੋਰ ਜ਼ਿਆਦਾ ਪਸ਼ੂਆਂ ਨੂੰ ਵਾਧਾ ਕਰਨ ਲਈ ਮੈਂ ਪੰਜਾਬ ਪੀ ਏ ਯੂ ਵਿੱਚ ਗਈ ਅਤੇ ਓੱਥੇ ਜਾ ਕੇ ਕਿਸਾਨਾਂ ਦੀ ਮਦਦ ਲਈ ਕਿਸਾਨਾਂ ਨੇ ਮੇਰੀ ਬਹੁਤ ਮਦਦ ਕੀਤੀ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਪਸ਼ੂਆਂ ਨੂੰ ਪਾਲਣ ਲਈ ਕਿਸ ਤਰ੍ਹਾਂ ਹੋਰ ਵਾਧਾ ਕਰ ਸਕਦੇ ਹੋ ਅਤੇ ਮੈਂ ਉਸ ਤਰ੍ਹਾਂ ਹੀ ਕੀਤਾ ਅਤੇ ਮੈਂ ਹੋਰ ਜ਼ਿਆਦਾ ਪਸ਼ੂ ਪਾਲਣ ਵਿੱਚ ਵਾਧਾ ਕੀਤਾ ਅਤੇ ਦੁੱਧ ਪਾਣਾ ਸ਼ੁਰੂ ਕੀਤਾ ਜਿਹੜਾ ਕਿ ਬਿਲਕੁਲ ਵੀ ਮਿਲਾਵਟ ਵਾਲਾ ਨਹੀਂ ਹੁੰਦਾ ਮੈਂ ਆਪਣੀ ਪਸ਼ੂ ਪਾਲਣ ਲ ਵਿੱਚ ਸ਼ੋਸ਼ਲ ਮੀਡੀਆ ਦੀ ਵੀ ਬਹੁਤ ਮਦਦ ਲਈ ਮੈਂ ਆਪਣੇ ਫਾਰਮ ਦੀ ਨਿਊਸ ਵਿੱਚ ਵੀ ਐਡ ਦਿੱਤੀ ਅਤੇ ਮੈਂ ਸ਼ੋਸ਼ਲ ਮੀਡੀਆ 'ਤੇ ਵੀ ਪੋਸਟ ਕੀਤਾ ਕਿ ਮੈਂ ਕਿੱਦਾਂ ਕਿੱਦਾਂ ਮਿਲਾਵਟ ਫ੍ਰੀ ਦੁੱਧ ਵੇਚਦੀ ਹਾਂ ਅਤੇ ਲੋਕਾਂ ਨੇ ਮੈਨੂੰ ਬਹੁਤ ਜ਼ਿਆਦਾ ਪ੍ਰਤੋਸਾਹਿਤ ਕੀਤਾ ਅਤੇ ਉਨ੍ਹਾਂ ਨੇ ਮੇਰੇ ਤੋਂ ਬਹੁਤ ਜ਼ਿਆਦਾ ਹੋਰ ਵੀ ਦੁੱਧ ਲੈਣਾ ਸ਼ੁਰੂ ਕੀਤਾ ਇੱਦਾਂ ਹੀ ਮੇਰੀ ਕਿਸਾਨਾਂ ਨੇ ਅਤੇ ਸ਼ੋਸ਼ਲ ਮੀਡੀਆ ਨੇ ਅਖ਼ਬਾਰ ਵਾ ਨਿਊਸ ਪੇਪਰ ਵਾਲਿਆਂ ਨੇ ਬਹੁਤ ਮਦਦ ਕੀਤੀ